ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੇਰੀ ਇੱਥੇ ਗੁਰੂ ਨਾਨਕ ਯੂਨੀਵਰਸਿਟੀ 'ਚ ਐਡਮਿਸ਼ਨ ਹੋਈ ਹੈ ਅਤੇ ਮੈਂ ਹਾਲੇ ਨਵੀਂ ਨਵੀਂ ਆਈ ਹਾਂ ਮੈਨੂੰ ਇੱਥੋਂ ਦੇ ਮੌਸਮ ਬਾਰੇ ਕੁਝ ਪਤਾ ਨਹੀਂ ਚੱਲ ਰਿਹਾ ਮੈਂ ਸੁਣਿਆ ਸੀ ਕਿ ਜਨਵਰੀ ਫਰਵਰੀ ਵਿੱਚ ਮੌਸਮ ਚੇਂਜ ਹੋ ਜਾਂਦਾ ਹੈ ਪਰ ਅਜੇ ਵੀ ਇੱਥੇ ਤਾਂ ਬਹੁਤ ਠੰਡ ਹੈ ਕਦੇ ਬਾਰਿਸ਼ ਹੋ ਜਾਂਦੀ ਹੈ ਇੱਥੋਂ ਦੀ ਕਲਾਈਮੇਟ ਬਾਰੇ ਮੈਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਹਾਂ ਬਸ 'ਤੇ ਸਾਡੇ ਮਿਲਣੀ ਹੋਈ ਸੀ ਮਿਲੇ ਸੀ ਅਸੀਂ ਤੁਸੀਂ ਮੈਨੂੰ ਕਿਹਾ ਸੀ ਕਿ ਕਿਸੇ ਵੀ ਕਿਸਮ ਦੀ ਜ਼ਰੂਰਤ ਹੋਵੇ ਤਾਂ ਦੱਸਿਓ ਮੈਨੂੰ ਤੁਹਾਡੀ ਨੇਚਰ ਕਾਫ਼ੀ ਚੰਗੀ ਲੱਗੀ ਅਤੇ ਮੈਂ ਸੋਚਿਆ ਕਿ ਤੁਹਾਡੇ ਕੋਲੋਂ ਹੀ ਕੋਈ ਥੋੜ੍ਹੀ ਬਹੁਤੀ ਜਾਣਕਾਰੀ ਪ੍ਰਾਪਤ ਕਰਾਂ ਪਰ ਅੱਜ ਵੀ ਬੱਦਲਵਾਈ ਹੋਈ ਹੋਈ ਆ ਕਾਫ਼ੀ ਠੰਡ ਹੋ ਗਈ ਮੈਂ ਤਾਂ ਇੰਨੇ ਕੱਪੜੇ ਵੀ ਨਹੀਂ ਲੈ ਕੇ ਆਈ

ਅੱਛਾ ਜੀ ਠੀਕ ਹੈ

ਹਾਂ ਜੁਲਾਈ ਅਗਸਤ ਵਿੱਚ ਦੇਖ ਸੁਣਿਆ ਸੀ ਦੇਖਿਆ ਸੀ ਕਿ ਬਹੁਤ ਗਰਮੀ ਹੋ ਜਾਂਦੀ ਹੈ

ਹਾਂ ਹਾਂਜੀ ਠੀਕ ਹੈ ਅਤੇ ਗੰਦਾ ਮੌਸਮ ਹੁੰਦਾ ਜੁਲਾਈ ਅਗਸਤ ਠੀਕ ਹੈ ਜੀ ਹਾਂ ਠੀਕ ਹੈ ਉਹ ਤਾਂ ਠੀਕ ਹੈ ਉਹ ਤਾਂ ਦਿਖ ਹੀ ਰਿਹਾ ਹੁਣ ਵੀ ਹਾਂਜੀ

ਹਾਂਜੀ ਅੱਛਾ ਜੀ ਅੱਛਾ ਠੀਕ ਠੀਕ ਹਾਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ